ਅੱਜ ਕੱਲ੍ਹ ਭਾਰਤ ਵਿੱਚ ਨੌਕਰੀਆਂ ਲੈਣਾ ਬੜਾ ਹੀ ਔਖਾ ਹੋ ਗਿਆ ਹੈ ਪਿਛਲੇ ਸਾਲਾਂ ਵਿੱਚ ਪਿਛਲੇ ਦਹਾਕਿਆਂ ਵਿੱਚ ਗੱਲ ਕਰੀਏ ਤਾਂ ਨੌਕਰੀਆਂ ਚੰਗੀਆਂ ਵੀ ਮਿਲ ਜਾਂਦ ਜਾਂਦੀਆਂ ਸੀ ਅਤੇ ਬਹੁਤ ਆਸਾਨੀ ਨਾਲ ਵੀ ਮਿਲ ਜਾਂਦੀਆਂ ਸੀ ਪਰ ਅੱਜ ਕੱਲ੍ਹ ਇੰਨਾਂ ਕੰਪਟੀਸ਼ਨ ਹੋ ਗਿਆ ਹੈ ਇੰਨੇ ਬੱਚੇ ਸਾਡੇ ਇੰਨੇ ਇੰਜੀਨੀਅਰ ਇੰਨੇ ਬੀ ਟੈਕ ਕਰਕੇ ਬੱਚੇ ਇੰਨੇ ਹੋਰ ਵੀ ਕੋਰਸਾਂ ਕਰਕੇ ਬੱਚੇ ਇੰਨੇ ਆਊਟਪੁੱਟ ਨਿਕਲ ਰਹੀ ਹੈ ਵੀ ਤੁਸੀਂ ਅੱਜ ਕੱਲ੍ਹ ਨੌਕਰੀ ਲੈਣਾ ਬੜਾ ਔਖਾ ਹੋ ਗਿਆ ਲੋਕਾਂ ਦਾ ਰੁਝਾਨ ਇਸ ਵਾਰ ਬਾਹਰ ਵੱਲ ਬਹੁਤ ਜ਼ਿਆਦਾ ਵੱਧਣ ਲੱਗ ਗਿਆ ਹੈ ਖਾਸ ਕਰ ਪੰਜਾਬ ਦੇ ਨੌਜਵਾਨ ਸਾਰੇ ਬਾਹਰ ਵੱਲ ਜਾ ਰਹੇ ਹਨ ਕਿਉਂਕਿ ਇੱਥੇ ਨੌਕਰੀਆਂ ਪ੍ਰਾਪਤ ਨਹੀਂ ਹੋ ਰਹੀਆਂ ਅਤੇ ਜੇ ਇੱਥੇ ਆਪਾਂ ਭੂਮਿਕਾ ਦੀ ਗੱਲ ਕਰੀਏ ਨਵੀਆਂ ਨਵੀਆਂ ਨੌਕਰੀਆਂ ਜਿਵੇਂ ਕਿ ਅੱਜ ਕੱਲ੍ਹ ਕਮੇਡੀਆਂ ਦੀਆਂ ਨੌਕਰੀਆਂ ਯੂਟਿਊਬਰ ਖਾਸ ਕਰਕੇ ਯੂਟਿਊਬ 'ਤੇ ਆਪਣੇ ਚੈਨਲ ਚਲਾਉਣ ਲੱਗ ਗਏ ਹਨ ਜਿਹਦੇ ਕਰਕੇ ਉਹਨਾਂ ਨੂੰ ਵਿਊਜ਼ ਮਿਲਦੇ ਹਨ ਅਤੇ ਵਿਊਜ਼ ਨਾਲ ਫਿਰ ਉਹਨਾਂ ਨੂੰ ਪੈਸੇ ਪ੍ਰਾਪਤ ਹੁੰਦੇ ਹਨ ਪਰ ਉਹਨਾਂ ਨੂੰ ਵੀ ਇਹ ਕੋਈ ਪਰਮਾਨੈਂਟ ਜਿਹੜੀ ਜ ਆਪਾਂ ਕਹਿ ਸਕਦੇ ਹਾਂ ਨੌਕਰੀ ਨਹੀਂ ਲੱਗਦੀ ਕਿਉਂਕਿ ਕਦੇ ਵੀ ਯੂਟਿਊਬ ਬੰਦ ਹੋ ਸਕਦਾ ਹੈ ਅਤੇ ਇੰਟਰਨੈਟ ਦੀ ਸੇਵਾਵਾਂ ਕਦੇ ਵੀ ਬੰਦ ਹੋ ਸਕਦੀਆਂ ਹੈ ਕਿਉਂਕਿ ਇਹਨਾਂ ਦੇ ਕਾਰਨ ਹੀ ਉਹ ਇੱਥੇ ਚੈਨਲ ਚਲਾ ਸਕਦੇ ਹਨ ਕਿਉਂਕਿ ਯੂਟਿਊਬ ਇੱਕ ਇੰਟਰਨੈਟ ਨਾਲ ਚੱਲਣ ਵਾਲਾ ਚੈਨਲ ਹੈ ਅਤੇ ਇਹ ਜੇ ਇੰਟਰਨੈਟ ਅੱਜ ਕੱਲ੍ਹ ਇੰਟਰਨੈਟ ਦੇ ਰੇਟ ਬੜੇ ਸ ਘੱਟ ਹਨ ਇੰਡੀਆ 'ਚ ਜੇ ਆਉਣ ਵਾਲੇ ਟਾਈਮ ਵਿੱਚ ਕੋਈ ਕ ਕੁਛ ਕੰਪਨੀਆਂ ਜਿਹੜੀਆਂ ਕਿ ਤਿੰਨ ਚਾਰ ਕੰਪਨੀਆਂ ਹੀ ਹਨ ਭਾਰਤ ਵਿੱਚ ਇਹ ਜੇ ਆਪਣੇ ਰੇਟ ਵਧਾਉਂਦੀਆਂ ਹਨ ਤਾਂ ਇਹਨਾਂ ਨੂੰ ਵੀ ਇਹਨਾਂ ਦੇ ਸਕਰੈ ਸਬਸਕ੍ਰਾਈਬਰ ਜਿਹੜੇ ਨੇ ਉਹ ਘੱਟ ਹੋ ਸਕਦੇ ਹਨ ਅਤੇ ਅੱਜ ਕੱਲ੍ਹ ਕਮੇਡੀਅਨ ਵੀ ਅੱਜ ਕੱਲ੍ਹ ਪ ਅੱਜ ਕੱਲ੍ਹ ਆਪਣੇ ਨਾਟਕ ਪੇਸ਼ ਕਰਕੇ ਸਟੇਜਾਂ 'ਤੇ ਉਹ ਵੀ ਅੱਜ ਕੱਲ੍ਹ ਇਹਨਾਂ ਨੂੰ ਨੌਕਰੀਆਂ ਦੇ ਤੌਰ 'ਤੇ ਦੇਖਦੇ ਹਨ ਅਤੇ ਪ ਇ ਇਸ ਲਈ ਨੌਜਵਾਨ ਜਿਹੜੇ ਨੇ ਹਮੇਸ਼ਾਂ ਹੀ ਜਿਹੜੀ ਪੱਕੀਆਂ ਨੌਕਰੀਆਂ ਜਿਹੜੀਆਂ ਕਿ ਅੱਜ ਕੱਲ੍ਹ ਜੇ ਆਪਾਂ ਕਹਿ ਸਕਦੇ ਹਾਂ ਸਰਕਾਰੀ ਨੌਕਰੀਆਂ ਦੀ ਉਡੀਕ ਵਿੱਚ ਰਹਿੰਦੇ ਹਨ ਜਿਹੜਾ ਕਿ ਉਹਨਾਂ ਨੂੰ ਨਹੀਂ ਮਿਲਦੀਆਂ ਹਨ